ਹੈਲੋ ਹਾਂਜੀ ਫਰਨੀਚਰ ਵਾਲੀ ਦੁਕਾਨ ਤੋਂ ਬੋਲਦੇ ਹੋ ਸਾਡੇ ਨਾ ਸੋਫੇ ਹੈਗੇ ਪਏ ਵੀਰ ਜੀ ਅਤੇ ਅਸੀਂ ਉਹ ਠੀਕ ਕਰਵਾਉਣੇ ਹੈਗੇ ਅਤੇ ਹਾਂ ਉਹਦੀ ਨਾ ਤੁਸੀਂ ਪੱਟੀਆਂ ਟੁੱਟੀਆਂ ਬਈ ਐਵੇਂ ਬਈ ਜੇ ਤੁਸੀਂ ਫੱਟੀਆਂ ਲਾ ਕੇ ਬਾਕੀ ਉਹਨੂੰ ਪੂਰਾ ਰਿਪੇਅਰ ਕਰਕੇ ਬਈ ਉਹਦੇ ਕਿੰਨੇ ਪੈਸੇ ਲਾਉਂਗੇ ਅਤੇ ਜੇ ਤੁਸੀਂ ਵਿੱਚ ਕੱਟ ਲਓਂਗੇ ਜੀ ਉਹਨੂੰ ਫਿਰ ਕਿੰਨੇ ਦਾ ਦਿਓਗੇ ਸਾਨੂੰ ਨਵਾਂ ਸੋਫਾ ਠੀਕ ਆ ਉਹ ਵਿੱਚ ਦੇ ਕੇ ਅਤੇ ਇੱਕ ਇੱਕ ਜੀ ਸਾਡੇ ਬੈਡ ਹੈਗੇ ਉਹਦੀ ਨਾ ਢੋਹ ਖ਼ਰਾਬ ਹੋਈ ਪਈ ਹੈਗੀ ਅਸੀਂ ਉਹਦੇ ਤੋਂ ਡਿਜ਼ੈਨ ਵਾਲੀ ਲਵਾਉਣੀ ਹੈਗੀ ਹਾਂਜੀ ਉਹਦਾ ਕੀ ਹਿਸਾਬ ਕਿਤਾਬ ਹੈ ਜੀ ਅਤੇ ਬਾਕੀ ਤੁਸੀਂ ਲੱਕੜੀ ਕਿਹੜੀ ਲਾਓਗੇ ਜੀ ਹਾਂਜੀ ਅਤੇ ਉਹਦਾ ਉਹਦਾ ਉਹਦਾ ਖਰਚਾ ਕਿੰਨਾ ਦੱਸਿਆ ਜੀ ਅਤੇ ਫੇਰ ਉਹਦੀ ਤੁਹਾਡੀ ਗਰੰਟੀ ਹੈ ਜੀ ਹਾਂ ਉਹਨੂੰ ਐਂਉਂ ਨਾ ਹੁਣ ਕੋਈ ਘੁਣ ਘਣ ਨਾ ਲੱਗੇ ਅੱਗੇ ਸਾਡੇ ਘੁਣ ਲੱਗ ਗਿਆ ਜੀ ਉਹਨੂੰ ਹਾਂਜੀ ਅਤੇ ਬਾਕੀ ਸਾਡੇ ਕੁਰਸੀਆਂ ਨੇ ਕੁਰਸੀਆਂ ਅਸੀਂ ਬਾਹਰੋਂ ਮੰਗਵਾਈਆਂ ਹੋਈਆਂ ਨੇ ਉਹਨਾਂ ਵੀ ਉਹਨਾਂ ਦੀ ਵੀ ਰਿਪੇਅਰ ਕਰਾਉਣੀ ਜੀ ਥੋੜ੍ਹੀ ਜਿਹੀ ਨਾਲ ਅਤੇ ਉਹ ਉਹਦਾ ਕੀ ਉਹਦਾ ਕੀ ਹਿਸਾਬ ਕਿਤਾਬ ਹੋਉਗਾ ਜੀ ਹਾਂਜੀ ਵੀ ਬਸ ਤੁਸੀਂ ਨਾ ਬਣਾ ਦਿਓ ਗਰੰਟੀ ਨਾਲ ਬਣਾ ਦਿਓ ਵੀ ਐਂਉਂ ਨਾ ਹੋਵੇ

ਠੀਕ ਹੈ ਇੱਕ ਇੱਕ ਇੱਕ ਹਾਂਜੀ ਇੱਕ ਸਾਡੇ ਦਰਵਾਜ਼ੇ ਹੈ ਜੀ ਉਹ ਦਰਵਾਜ਼ਿਆਂ ਦੀ ਨਾ ਜਿਹੜੀ ਸ਼ੈਡ ਵਾਲੀ ਹੁੰਦੀ ਹੈਗੀ ਉਹ ਨੁੱਕਰ ਜੀ ਕੋਨ ਜੀ ਹਾਂਜੀ ਉਹ ਵੀ ਸਾਡੀ ਉਹ ਟੁੱਟੀ ਪਈ ਹੈ ਬਈ ਉਹਦੇ ਅਤੇ ਉਹ ਵੀ ਤੁਸੀਂ ਕਰ ਦਿਓਗੇ ਜੀ ਠੀਕ ਉਹ ਉਹ ਤੁਸੀਂ ਪਲਾਈ ਲਾਓਗੇ ਜਾਂ ਕੀ ਸਮਰੈਕਾਂ ਲਾਓਗੇ ਜੀ ਹਾਂਜੀ ਹੈ ਸਮਰੈਕਾਂ ਹੀ ਬਹੁਤ ਵਧੀਆ ਲਾਉਣਾ ਹੈਗਾ ਐਂਉਂ ਨਹੀਂ ਹੈਗਾ ਆਪਾਂ ਨੇ ਟੈਂਪਰੇਲੀ ਨਹੀਂ ਲਾਉਣਾ ਠੀਕ ਹੈ ਜੀ ਐਂਉਂ ਨਾ ਵੀ ਸਾਡੇ ਪਹਿਲਾਂ ਬਹੁਤ ਵਧੀਆ ਲੱਗੇ ਹੋਏ ਹੈਗੇ ਵੀ ਹੁਣ ਵਧੀਆ ਲਾਉਣੇ ਜੀ ਠੀਕ ਹੈ ਜੀ ਓਕੇ ਜੀ ਬਾਏ